ਮੈਂ ਇਸ ਸਮੇਂ ਆਪ ਤੋਂ ਕੁਛ ਵੀ ਨਹੀਂ ਕਮਾਉਂਦੀ ਮੈਂ ਇਸ ਟਾਈਮ ਇੱਕ ਸਟੂਡੈਂਟ ਹਾਂ ਅਤੇ ਮੈਂ ਲੋਅ ਦੀ ਸਟੱਡੀ ਕਰ ਰਹੀ ਹਾਂ ਮੈਨੂੰ ਮੇਰੀ ਸਟੱਡੀ ਪੰਜ ਸਾਲ ਦੀ ਹੈ ਅਤੇ ਮੇਰੇ ਤਿੰਨ ਸਾਲ ਪੂਰੇ ਹੋ ਚੁੱਕੇ ਹਨ ਅਤੇ ਚੌਥਾ ਸਾਲ ਚੱਲ ਰਿਹਾ ਮੇਰਾ ਕੋਲਿਜ ਦੇ ਵਿੱਚ ਡੇਢ ਸਾਲ ਰਹਿ ਗਿਆ ਹੈ ਇਸ ਕਰੀ ਮੈਂ ਲੋਅ ਦੀ ਫੀਲਡ ਵਿੱਚ ਬਚਪਨ ਤੋਂ ਹੀ ਆਉਣਾ ਚਾਹੁੰਦੀ ਸੀ ਮੇਰਾ ਲੋਅ ਦੇ ਵਿੱਚ ਸ਼ੁਰੂ ਤੋਂ ਹੀ ਕਾਫ਼ੀ ਇੰਟਰਸਟ ਸੀ ਮੇਰਾ ਮਨ ਸੀ ਕਿ ਮੈਂ ਲੋਅ ਲੋਅ ਦੀ ਪੜ੍ਹਾਈ ਕਰਾਂ ਅਤੇ ਜੱਜ ਬਣਾ ਅਤੇ ਮੇਰੇ ਪਾਪਾ ਜਿਵੇਂ ਕਿ ਐਡਵੋਕੇਟ ਹਨ ਉਹ ਵੀ ਇਹੀ ਚਾਹੁੰਦੇ ਸਨ ਅਤੇ ਮੇਰੇ ਘਰਦਿਆਂ ਦੇ ਕਾਫ਼ੀ ਸਾਰੇ ਸਪਨੇ ਆ ਮੇਰੇ ਤੋਂ ਹੁਣ ਇਹ ਪੰਜ ਸਾਲ ਦੀ ਪੜ੍ਹਾਈ ਪੂਰੀ ਹੋਣ ਤੋਂ ਬਾਅਦ ਵਿੱਚ ਮੈਂ ਆਪਣੇ ਅੱਗੇ ਕਰੀਅਰ ਵਿੱਚ ਜੋ ਮੇਨ ਕਰਨਾ ਉਹ ਦੀ ਤਿਆਰੀ ਕਰਨੀ ਸ਼ੁਰੂ ਕਰਾਂਗੀ ਮੈਂ ਕੋਚਿੰਗ ਲੈਣੀ ਉਹ ਤੋਂ ਬਾਅਦ ਵਿੱਚ ਕੋਚਿੰਗ ਲੈਣ ਤੋਂ ਬਾਅਦ ਵਿੱਚ ਮੈਂ ਜੁਡੀਸ਼ਰੀ ਦਾ ਪੇਪਰ ਕਲੀਅਰ ਕਰਨਾ ਜੁਡੀਸ਼ਰੀ ਦਾ ਪੇਪਰ ਕਲੀਅਰ ਹੁੰਦਾ ਹੈ ਤਾਂ ਬਹੁਤ ਵਧੀਆ ਗੱਲ ਅਗਰ ਨਹੀਂ ਹੁੰਦਾ ਤਾਂ ਉਹ ਤੋਂ ਬਾਅਦ ਵਿੱਚ ਮੈਂ ਐਡਵੋਕੇਟ ਬਣਨਾ ਚਾਹੂੰਗੀ ਅਤੇ ਉ ਆਪਣੇ ਫਾਦਰ ਦੇ ਨਾਲ ਹੀ ਪ੍ਰੈਕਟਿਸ ਕਰਨਾ ਚਾਹੂੰਗੀ ਅਤੇ ਬਟ ਮੇਰੀ ਮੇਨ ਕੋਸ਼ਿਸ਼ ਇਹੀ ਰਹੇਗੀ ਕਿ ਮੇਰਾ ਜੁਡੀਸ਼ਰੀ ਦਾ ਪੇਪਰ ਕਲੀਅਰ ਹੋ ਜਾਵੇ ਅਤੇ ਕਲੀਅਰ ਹੋਣ ਤੋਂ ਬਾਅਦ ਵਿੱਚ ਮੈਂ ਜੱਜ ਲੱਗ ਸਕਾਂ ਮੈਂ ਇੱਕ ਸਾਲ ਨਹੀਂ ਮੈਂ ਕਾਫ਼ੀ ਬਾਰ ਆਪਣੀ ਪੂਰੀ ਮਿਹਨਤ ਕਰੂੰਗੀ ਇੱਕ ਨਹੀਂ ਹੋਰ ਵੀ ਕਾਫ਼ੀ ਸਾਰੇ ਅਟੈਂਮਪਟ ਦਊਂਗੀ ਇੱਕ ਵਾਰ ਅਟੈਂਮਪਟ ਦੇਣ ਤੋਂ ਬਾਅਦ ਅਗਰ ਮੇਰਾ ਕਲੀਅਰ ਨਹੀਂ ਹੋਇਆ ਮੈਂ ਹਾਰ ਨਹੀਂ ਮੰਨੂਗੀ ਉਸ ਤੋਂ ਬਾਅਦ ਵਿੱਚ ਵੀ ਮੈਂ ਅਟੈਂਮਪਟ ਦਊਂਗੀ ਜਿੰਨੀ ਮੇਰੇ ਤੋਂ ਹੋ ਸਕੇ ਮੈਂ ਉਨੀਂ ਮਿਹਨਤ ਕਰੂੰਗੀ ਅਤੇ ਜੋ ਮੇਰਾ ਸਪਨਾ ਮੈਂ ਚਾਹੂੰਗੀ ਕਿ ਮੈਂ ਆਪਣਾ ਪੂਰਾ ਕਰਾਂ ਅਤੇ ਅ ਅਗਰ ਮੇਰਾ ਸਪਨਾ ਪੂਰਾ ਹੁੰਦਾ ਹੈ ਤਾਂ ਮੇਰੇ ਘਰਦਿਆਂ ਨੂੰ ਜਿੰਨੀ ਖੁਸ਼ੀ ਹੋਵੇਗੀ ਮੇਰੇ ਪਾਪਾ ਨੂੰ ਜਿੰਨੀ ਖੁਸ਼ੀ ਹੋਵੇਗੀ ਮੇਰੇ ਮੰਮਾ ਜਿੰਨੀ ਖੁਸ਼ੀ ਹੋਵੇਗੀ ਉੱਨੀ ਮੈਂ ਦੱਸ ਨਹੀਂ ਸਕਦੀ ਉਹਨਾਂ ਦਾ ਸ਼ੁਰੂ ਤੋਂ ਜਦੋਂ ਮੈਂ ਛੋਟੀ ਸੀ ਉਦੋਂ ਤੋਂ ਇਹੀ ਸੋਚਦੇ ਹਨ ਅਤੇ ਅਗਰ ਮੈਂ ਅੱਜ ਉਹਨਾਂ ਨੂੰ ਇਹ ਕਰਕੇ ਦਿਖਾਉਂਦੀ ਆਂ ਤਾਂ ਉਨ੍ਹਾਂ ਜਿੰਨਾ ਖੁਸ਼ ਕੋਈ ਨਹੀਂ ਹੋਵੇਗਾ